ਭੰਗੜਾ ਪੰਜਾਬ ਦਾ ਲੋਕ ਨਾਚ ਹੈ ਇਹ ਪੰਜਾਬ ਦੀ ਸ਼ਾਨ ਹੈ ਇਹਦੇ ਨਾਲ ਬੰਦਾ ਆਪਣਾ ਸਰੀਰ ਫਿੱਟ ਰੱਖ ਸਕਦਾ ਹੈ ਖੁੱਲ੍ਹੇ ਤਰੀਕੇ ਨਾਲ ਨੱਚਦਾ ਹੈ ਗਾਉਂਦਾ ਹੈ ਆਪ ਹੀ ਨੱਚ ਗਾਉਂਦਾ ਅਤੇ ਆਪ ਹੀ ਨੱਚਦਾ ਹੈ ਪਰ ਲੋਕ ਵੈਸਟਰਨ ਡਾਂਸ ਵੱਲ ਭੱਜ ਰਹੇ ਨੇ ਪਰ ਭੰਗੜਾ ਹੈਗਾ ਜਿਹੜਾ ਖੁਸ਼ੀਆਂ ਨਾਲ ਭਰਿਆ ਹੁੰਦਾ ਹੈਗਾ ਹੈ ਇਹਨੂੰ ਅਸੀਂ ਇੰਜੋਇਮੈਂਟ ਦੇ ਤੌਰ 'ਤੇ ਵੀ ਰੱਖਦੇ ਹਾਂ ਇਹ ਵਿਆਹਵਾਂ ਦੇ ਵਿੱਚ ਸ਼ੋਆਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਂਦਾ ਹੈ ਪੰਜਾਬ ਦਾ ਵਿਰਸਾ ਹੈਗਾ ਸੱਭਿਆਚਾਰ ਹੈਗਾ ਕਿਉਂਕਿ ਪਹਿਲਾਂ ਦੇ ਸਮੇਂ ਵਿੱਚ ਵਿਆਹਵਾਂ ਦੇ ਵਿੱਚ ਆਪ ਹੀ ਗਾਉਂਦੇ ਸੀ ਆਪ ਹੀ ਨੱਚਦੇ ਸੀ ਤਾਂ ਹੁਣ ਇਹ ਸਾਰਿਆਂ ਦੀ ਜਾਨ ਬਣ ਗਈ ਹੈ ਮਤਲਬ ਕਿ ਪਹਿਲਾਂ ਵਾਲੇ ਵਿਰਸੇ ਨੂੰ ਛੱਡ ਕੇ ਲੋਕ ਹੁਣ ਦੇ ਵਿਰਸੇ ਨੂੰ ਅਪਣਾਈ ਜਾ ਰਹੇ ਹਨ ਜਿਹੜਾ ਪਹਿਲਾਂ ਦਾ ਵਿਰਸਾ ਹੈਗਾ ਲੋਕ ਨਾਚ ਹੈਗਾ ਇਹ ਬਹੁਤ ਵਧੀਆ ਗਾ ਪੰਜਾਬ ਦੇ ਭੰਗੜੇ ਦੇ ਇਲਾਵਾ ਜਿਵੇਂ ਮਲਵਈ ਗਿੱਧਾ ਸੰਮੀ ਹੋਰ ਵੀ ਕਈ ਤਰੀਕੇ ਦੇ ਨਾਚ ਹੈ ਲੁੱਡੀ ਪਾਉਂਦੇ ਸੀ ਲੁੱਡੀ ਪਾਉਂਦੇ ਸੀਗੇ ਅਤੇ ਗਿੱਧਾ ਪਾਉਂਦੇ ਸੀ ਤੀਵੀਆਂ ਵੀ ਨੱਚਦੀਆਂ ਸੀ ਗਾਉਂਦੀਆਂ ਸੀ ਭੰਗੜਾ ਪਾਉਂਦੀਆਂ ਸੀ ਇਹ ਬਹੁਤ ਜ਼ਿਆਦਾ ਵਧੀਆ ਵਧੀਆ ਵਿਰਸਾ ਹੈ ਭੰਗੜਾ ਲੋਕ ਨਾਚ ਹੈ ਪੰਜਾਬ ਦਾ